ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਇਹ ਹੈਲਪਲਾਈਨ ਨੰਬਰ ਹੈ ਸਰ ਐਕਚੂਲ਼ੀ ਮੈਂ ਇਹ ਰਿਕੁਐਸਟ ਕਰਨੀ ਸੀ ਕਿ ਮੈਂ ਦੋ ਕੰਪਲੇਨਸ ਪਾਉਣੀਆਂ ਹੈ ਸਰ ਮੈਂ ਨਾ ਬੁੱਕਸ ਦੀ ਡਿਲੀਵਰੀ ਮੰਗਵਾਈ ਸੀ ਇੱਕ ਤਾਂ ਉਹ ਬੁੱਕਸ ਲੇਟ ਆਈਆਂ ਲੇਟ ਤਾਂ ਆਈਆਂ ਚਲੋ ਉਹ ਗੱਲ ਕੋਈ ਨਹੀਂ ਬਟ ਉਹ ਬੁੱਕਸ ਜੋ ਕੀ ਆ ਉਹ ਡਿਫੈਕਟਿਵ ਬੁੱਕਸ ਹੈ ਡਿਫੈਕਟ ਇਨ ਦੀ ਸੇਂਸ ਕਿ ਉਹ ਨਾ ਬੁੱਕਸ ਦੇ ਵਿੱਚ ਇੱਕ ਤਾਂ ਇੱਕ ਦੋ ਪੇਜ਼ ਫਟੇ ਹੋਏ ਸੀ ਐਂਡ ਪ੍ਰੋਪਰ ਉਹ ਵੀ ਨਹੀਂ ਸੀਗੀ ਕਵਰੀ ਤਾਂ ਮੈਂ ਇਹ ਕੰਪਲੇਨ ਪਾਉਣੀ ਸੀ ਕਿ ਜਾਂ ਤਾਂ ਇਹ ਪੀਸ ਤੁਸੀਂ ਵਾਪਿਸ ਕਰ ਦਓ ਐਂਡ ਕੰਪਲੇਨ ਇਹ ਪਾਉਣੀ ਆ ਕਿ ਮੇਰਾ ਨਾਲ ਨਾਲ ਟਾਈਮ ਵੀ ਵੇਸਟ ਹੋਇਆ ਵਾ ਤਾਂ ਦੇਖ ਲਓ ਸਰ ਤੁਸੀਂ ਇਹ ਓਡਰ ਨਾਲ ਕੈਂਸਲ ਕਰ ਦਓ ਸਰ ਓਡਰ ਮੇਰਾ ਮੋਨਿਕਾ ਨੇਮ ਤੋਂ ਸੀਗਾ ਨਹੀਂ ਸਰ ਓਨਲੀ ਮੋਨਿਕਾ ਓਨਲੀ ਮੋਨਿਕਾ ਸਰ ਮੈਂ ਬਿਜ਼ਨਸ ਸਟੱਡੀ ਦੀ ਬੁੱਕ ਮੰਗਵਾਈ ਸੀ ਨਹੀਂ ਸਰ ਮੈਂ ਕਮਰਸ ਦੀ ਸਟੂਡੈਂਟ ਹਾਂ ਸੋ ਉਹਦੇ ਵਿੱਚ ਇੱਕ ਸਬਜੈਕਟ ਹੈਗਾ ਬਿਜ਼ਨਸ ਸਟੱਡੀ ਅਤੇ ਉਹਦੇ ਰਿਲੇਟਡ ਮੈਂ ਬੁੱਕ ਮੰਗਵਾਈ ਸੀਗੀ ਪੀ ਐੱਸ ਈ ਬੀ ਦੀ ਹਾਂਜੀ ਸਰ ਇੱਕ ਤਾਂ ਇਹ ਜਿਹੜਾ ਓਡਰ ਹੈ ਇਹ ਕੈਂਸਲ ਕਰ ਦਓ ਉਪਰੋਂ ਦੀ ਕੰਪਲੇਨ ਇਹ ਵੀ ਪਾਉਣੀ ਕਿ ਮੇਰਾ ਟਾਈਮ ਵੀ ਵੇਸਟ ਹੋਇਆ

ਹਾਂਜੀ ਇਸ ਲਈ ਕਹਿ ਰਹੀ ਹਾਂ ਹਾਂਜੀ ਇਸ ਲਈ ਕਹਿ ਰਹੀ ਕਿ ਇਹ ਵਾਲਾ ਓਡਰ ਕੈਂਸਲ ਕਰ ਦਓ ਮੈਂ ਕਿਸੀ ਔਰ ਤੋਂ ਬੁੱਕ ਓਡਰ ਕਰਵ ਕਰਵਾ ਲਊਂਗੀ ਓਕੇ ਸਰ ਥੈਂਕ ਯੂ ਜੇ ਰਿਫੰਡ ਵਾਪਿਸ ਹੋ ਰਿਹਾ ਫਿਰ ਤਾਂ ਬਹੁਤ ਬਹੁਤ ਥੈਂਕ ਯੂ ਓਕੇ ਸਰ ਥੈਂਕ ਯੂ